ਜੀਵਨ ਦੇ ਵਿੱਚ ਸਾਨੂੰ ਪਾਣੀ ਦੀ ਸਭ ਤੋਂ ਵੱਧ ਜ਼ਰੂਰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਰ ਸਮੇਂ ਲੋੜ ਪੈਂਦੀ ਹੈ ਜਿਸ ਤਰ੍ਹਾਂ ਕਿ ਸਾਡੇ ਸਰੀਰ ਵਿੱਚ ਵੀ ਸੱਤਰ ਪ੍ਰਸੈਂਂਟ ਪਾਣੀ ਹੈ ਅਤੇ ਧਰਤੀ 'ਤੇ ਜੋ ਵਾਤਾਵਰਨ ਹੈ ਸਾਰਾ ਕੁਛ ਉਸ ਵਿੱਚ ਵੀ ਸੱਤਰ ਪ੍ਰਸੈਂਟ ਪਾਣੀ ਹੈ ਇਸ ਕਰਕੇ ਪਾਣੀ ਦੀ ਜਿਹੜੀ ਮਹੱਤਤਾ ਹੈ ਸਾਡੇ ਸਵੇਰ ਤੋਂ ਉੱਠ ਕੇ ਨਹਾਉਣ ਤੋਂ ਬੁਰਸ਼ ਕਰਨ ਤੋਂ ਸ਼ੁਰੂ ਹੋ ਕੇ ਸਾਰੇ ਦਿਨ ਦੇ ਕੰਮਾਂ ਕਾਰਾਂ 'ਚ ਰੋਜ਼ੀ ਰੋਟੀ ਦਾਲਾਂ ਸਬਜ਼ੀਆਂ ਸਭ ਦਾ ਜੋ ਨਿਰਵਾਹ ਹੈ ਪਾਣੀ ਤੋਂ ਬਿਨ੍ਹਾਂ ਨਹੀਂ ਹੋ ਸਕਦਾ ਇਸ ਕਰਕੇ ਪਾਣੀ ਫਸਲਾਂ ਬੂਟਿਆਂ ਅਤੇ ਪ੍ਰਕ੍ਰਿਤੀ ਦੇ ਵਿੱਚ ਹਰ ਹੋਂਦ ਜਿਹੜੀ ਹੈ ਪਾਣੀ ਤੋਂ ਬਿਨ੍ਹਾਂ ਕੋਈ ਵੀ ਜੀਵਨ ਨਹੀਂ ਹੋ ਸਕਦਾ ਇਸ ਕਰਕੇ ਪਾਣੀ ਮਨੁੱਖ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਬਣ ਚੁੱਕੀ ਹੈ ਪਾਣੀ ਤੋਂ ਬਿਨ੍ਹਾਂ ਜੀਵਨ ਬੇਅਰਥ ਹੈ ਪਸ਼ੂਆਂ ਪੰਛੀਆਂ ਕੀੜੇ ਮਕੌੜੇ ਜੋ ਵੀ ਜੀਵ ਹਨ ਸਭ ਦਾ ਪਾਣੀ ਤੋਂ ਬਗੈਰ ਕੋਈ ਵੀ ਪਾਰ ਉਤਾਰਾ ਨਹੀਂ ਹੈ ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਪਾਣੀ ਦੀ ਬਹੁਤ ਵੱਡੀ ਮਹੱਤਤਾ ਹੈ ਪਾਣੀ ਨਾਲ ਹੀ ਜੀਵਨ ਨੂੰ ਜੀਆ ਜਾ ਸਕਦਾ ਹੈ ਪਾਣੀ ਤੋਂ ਬਿਨ੍ਹਾਂ ਤਾਂ ਜ਼ਿੰਦਗੀ ਜੀਵਨ ਬਿਲਕੁਲ ਹੀ ਅਧੂਰਾ ਹੈ ਇਸ ਤੋਂ ਬਿਨ੍ਹਾਂ ਜ਼ਿੰਦਗੀ ਹੀ ਕਿਸੇ ਵੀ ਚੀਜ਼ ਦੀ ਨਹੀਂ ਹੋ ਸਕਦੀ ਪਾਣੀ ਸਾਰੀਆਂ ਹੀ ਲੋੜਾਂ ਸਾਡੀਆਂ ਪੂਰੀਆਂ ਕਰਦਾ ਹੈ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਸ ਦਾ ਪਾਣੀ ਤੋਂ ਬਿਨ੍ਹਾਂ ਸਾਡਾ ਸਰ ਸਕਦਾ ਹੋਵੇ ਇਸ ਲਈ ਸਾਡੀ ਜ਼ਿੰਦਗੀ ਵਿੱਚ ਪਾਣੀ ਦੀ ਬਹੁਤ ਹੀ ਮਹੱਤਤਾ ਹੈ ਧੰਨਵਾਦ